ਪੰਜਾਬ ਵਿੱਚ ਪਹਿਲਾਂ ਟੈਕਨੋਲੋਜੀ ਬਹੁਤ ਘੱਟ ਸੀ ਅਤੇ ਲੋਕ ਇਨ ਇਸ ਦੀ ਵਰਤੋਂ ਬਹੁਤ ਘੱਟ ਕਰਦੇ ਸਨ ਪਰ ਜਿਵੇਂ ਜਿਵੇਂ ਟੈਕਨੋਲੋਜੀ ਅੱਗੇ ਵਧੀ ਉਵੇਂ ਉਵੇਂ ਇਸਦੀ ਵਰਤੋਂ ਸਭ ਜਗ੍ਹਾ ਹੋਣ ਲੱਗ ਗਈ ਜਿਸ ਕਾਰਨ ਪੰਜਾਬ ਵੀ ਪੰਜਾਬ ਵਿੱਚ ਵੀ ਬਹੁਤ ਵਰਤੋਂ ਹੋਣ ਲੱਗ ਪਈ ਅਤੇ ਅੱਜ ਕੱਲ੍ਹ ਇਸ ਤੋਂ ਬਿਨਾਂ ਇਹ ਆਪਣੀ ਜ਼ਿੰਦਗੀ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਜਿਸ ਕਾਰਨ ਅੱਜ ਕੱਲ੍ਹ ਜਦੋਂ ਵੀ ਆਪਾਂ ਨੂੰ ਕਿਸੇ ਚੀਜ਼ ਜ਼ਰੂਰਤ ਪੈਂਦੀ ਹੈ ਤਾਂ ਆਪਾਂ ਇਸ ਦੀ ਵਰਤੋਂ ਕਰਕੇ ਕੋਈ ਨਾ ਕੋਈ ਖੋਜਬੀਨ ਕਰ ਸਕਦੇ ਹਾਂ ਜਿਵੇਂ ਪਹਿਲਾਂ ਲੋਕ ਕੋਈ ਨਾ ਕੋਈ ਪੜ੍ਹਾਈ ਕਰਕੇ ਉਸ ਤੋਂ ਬਾਅਦ ਉਹਨਾਂ ਦੇ ਕੋਲ ਬਹੁਤ ਘੱਟ ਚੀਜ਼ਾਂ ਬਚਦੀਆਂ ਸਨ ਜੋ ਕਿ ਉਹ ਅੱਗੇ ਜਾ ਕੇ ਕਰ ਸਕਦੇ ਸਨ ਪਰ ਅੱਜ ਕੱਲ੍ਹ ਉਹ ਪੜ੍ਹ ਲਿਖ ਕੇ ਉਹ ਅੱਗੇ ਪੜ੍ਹਨ ਬਾਰੇ ਵੀ ਸੋਚ ਸਕਦੇ ਹਨ ਅਤੇ ਉਸ ਦੇ ਨਾਲ ਹੋਰ ਚੀਜ਼ਾਂ ਵੀ ਪਤਾ ਕਰ ਸਕਦੇ ਹਨ ਕਿ ਇਹ ਚੀਜ਼ ਕਰਨ ਨਾਲ ਉਹਨਾਂ ਨੂੰ ਅੱਗੇ ਜਾ ਕੇ ਕਿਸ ਚੀਜ਼ ਬਾਰੇ ਪਤਾ ਲੱਗੇਗਾ ਕਿ ਕਿਸ ਲਾਈਨ ਦੇ ਵਿੱਚ ਉਹ ਜਾ ਸਕਦੇ ਹਨ ਪਰ ਅੱਜ ਕੱਲ੍ਹ ਹੁਣ ਉਹਨਾਂ ਕ ਦੇ ਕੋਲ ਬਹੁਤ ਜ਼ਿਆਦਾ ਆਪਸ਼ਨਸ ਹੋ ਚੁੱਕੀਆਂ ਹਨ ਜਿਸ ਨਾਲ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਕਰਨਾ ਬਹੁਤ ਸੌਖਾ ਹੋ ਗਿਆ ਹੈ ਅਤੇ ਅੱਜ ਕੱਲ੍ਹ ਉਹ ਜਿਵੇਂ ਪੜ੍ਹ ਲਿਖ ਕੇ ਉਹਨਾਂ ਦੇ ਕੋਲ ਅੱਗੇ ਕਰਨ ਵਾਸਤੇ ਕੋਈ ਨਾ ਕੋਈ ਕੰਮ ਵਗੈਰਾ ਵੀ ਇਸ 'ਤੇ ਹੀ ਪਤਾ ਕਰ ਸਕਦੇ ਹਨ ਜਿਵੇਂ ਕਿ ਉਹ ਕੋਈ ਕਿਸੇ ਚੀਜ਼ ਬਾਰੇ ਸਿੱਖਣਾ ਚਾਹੁੰਦੇ ਹਨ ਅਤੇ ਉਸ ਬਾਰੇ ਇਸ 'ਤੇ ਸਰਚ ਕਰਦੇ ਹਨ ਤਾਂ ਉਸ ਬਾਰੇ ਉਹ ਪੂਰੀ ਤਰ੍ਹਾਂ ਸਿੱਖ ਸਕਦੇ ਹਨ ਜੇ ਉਹਨਾਂ ਨੂੰ ਇਹ ਚੀਜ਼ ਸ਼ੁਰੂ ਪਸੰਦ ਆਈ ਤਾਂ ਉਹ ਉਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਣਗੇ ਅਤੇ ਇਸ ਤਰ੍ਹਾਂ ਉਹਨਾਂ ਦਾ ਵਿਕਾਸ ਹੋਵੇਗਾ ਅਤੇ ਇਸ ਵਿਕਾਸ ਨਾਲ ਪੰਜਾਬ ਦਾ ਵੀ ਵਿਕਾਸ ਹੋਵੇਗਾ ਅਤੇ ਇਸ ਕਾਰਨ ਉਹਨਾਂ ਦੀ ਜਾ ਬ ਬੌਧਿਕ ਜਾਇਦਾਦ ਵੀ ਬਹੁਤ ਵਧੇਗੀ ਅਤੇ ਇਸ ਨਾਲ ਪੰਜਾਬ ਦਾ ਵੀ ਬਹੁਤ ਵਿਕਾਸ ਹੋਵੇਗਾ ਅਤੇ ਇਸ ਟੈਕਨੋਲੋਜੀ ਕਰਕੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਵੀ ਬਹੁਤ ਤਰੱਕੀ ਹੋ ਰਹੀ ਹੈ ਅੱਜ ਕੱਲ੍ਹ ਸਾਰੀਆਂ ਚੀਜ਼ਾਂ ਟੈਕਨੋਲੋਜੀ ਤੋਂ ਬਿਨਾਂ ਕੰਮ ਨਹੀਂ ਕਰਦੀਆਂ ਅਤੇ ਇਹ ਆਪਣੇ ਜ਼ਿੰਦਗੀ ਨਾਲ ਬਹੁਤ ਹੀ ਮਹੱਤਵਪੂਰਨ ਹਿੱਸਾ ਬਣ ਗਈ ਹੈ